ਮੇਰੇ ਕੋਲ ਸਭ ਤੋਂ ਪਹਿਲਾ ਫੋਨ ਜਿਹੜਾ ਸੀ ਉਹ ਨੋਕੀਆ ਸੀ ਟੂ ਸੀ ਉਹ ਮੈਂ ਕਹਿੰਦੀ ਬਹੁਤ ਵਧੀਆ ਫੋਨ ਸੀ ਕਿਉੰਕਿ ਸਿਰਫ ਕੋਲ ਹੋਣੀ ਸੀ ਉਹਦੇ 'ਚ ਸਿਰਫ ਅਸੀਂ ਕਿਸੇ ਨੂੰ ਕੋਲ ਕਰਦੇ ਸੀ ਤਾਂ ਹੀ ਗੱਲਬਾਤ ਹੁੰਦੀ ਸੀ ਉਹ 'ਤੇ ਕੋਈ ਇੰਟਰਨੈਟ ਨਹੀਂ ਸੀ ਚੱਲਦਾ ਕੋਈ ਸੋਸ਼ਲ ਮੀਡੀਆ ਹੁੰਦਾ ਹੀ ਨਹੀਂ ਸੀ ਕਿਉਂਕਿ ਉਹ ਤਾਂ ਫਿਰ ਇੱਕ ਇੱਕ ਸਿੰਪਲ ਫੋਨ ਹੁੰਦਾ ਸੀ ਨਾ ਤਾਂ ਉਹਦੇ 'ਤੇ ਸਿਰਫ ਇੱਕ ਸਿੰਪਲ ਟੈਕਸਟ ਮੈਸੇਜ ਹੋ ਜਾਂਦੇ ਸੀ ਤਾਂ ਫਿਰ ਉਹ ਵਧੀਆ ਸੀ ਉਹ ਲਾਈਫ ਬਹੁਤ ਵਧੀਆ ਸੀਗੀ ਉਸ ਤੋਂ ਬਾਅਦ ਸਮਾਰਟ ਫੋਨ ਆ ਗਏ ਸਮਾਰਟ ਫੋਨ ਆਉਣ ਨਾਲ ਟੈਕਨੋਲਜੀ ਤਾਂ ਬਿਲਕੁਲ ਹੀ ਬਦਲ ਗਈ ਕਿਉਂਕਿ ਸਮਾਰਟ ਫੋਨਸ ਆਉਣ ਦੇ ਨਾਲ਼ ਨਾਲ਼ ਅਸੀਂ ਹੋਰ ਜ਼ਿਆਦਾ ਐਕਟਿਵ ਹੋ ਗਏ ਹਾਂ ਅਸੀਂ ਸ਼ੋਸ਼ਲ ਮੀਡੀਆ 'ਤੇ ਐਕਟਿਵ ਅਸੀਂ ਹਰ ਇੱਕ ਜੋ ਆਪਣੀ ਅਸੀਂ ਐਕਟੀਵਿਟੀ ਕਰ ਰਹੇ ਹਾਂ ਉਹਨੂੰ ਅਸੀਂ ਸ਼ੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਾਂ ਅਸੀਂ ਕਿਤੇ ਜਾ ਰਹੇ ਹਾਂ ਤਾਂ ਵੀ ਦੱਸ ਦਿੰਦੇ ਹਾਂ ਅਸੀਂ ਇੱਥੇ ਫਲਾਨੀ ਜਗ੍ਹਾ ਅਸੀਂ ਕਿਤੇ ਕਿਤੋਂ ਘੁੰਮ ਕੇ ਆਏ ਹਾਂ ਤਾਂ ਵੀ ਦੱਸ ਦਿੰਦੇ ਹਾਂ ਜੀ ਅਸੀਂ ਇੱਥੇ ਆਏ ਹਾਂ ਅਸੀਂ ਕਿਤੇ ਸ਼ੋਪਿੰਗ ਕਰਨ ਜਾ ਰਹੇ ਹਾਂ ਅਸੀਂ ਤਾਂ ਵੀ ਦੱਸ ਦਿੰਦੇ ਹਾਂ ਜੀ ਅਸੀਂ ਸ਼ੋਪਿੰਗ ਕਰਕੇ ਆਏ ਹਾਂ ਅਸੀਂ ਖਾਣਾ ਖਾਣ ਜਾ ਰਹੇ ਉਹਦੀਆਂ ਫੋਟੋ ਵੀ ਪੋਸਟ ਕਰ ਦਿੰਦੇ ਜੀ ਅਸੀਂ ਆਹ ਖਾਧਾ ਜੀ ਅੱਜ ਅਸੀਂ ਮਤਲਬ ਪੂਰੀ ਦੁਨੀਆਂ ਨੂੰ ਦੱਸ ਦਿੰਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਅੱਜ ਅਸੀਂ ਕੀ ਕੀਤਾ ਏ ਸਮਾਰਟ ਫੋਨ ਆਉਣ ਨਾਲ਼ ਬਹੁਤ ਜ਼ਿਆਦਾ ਟੈਕਨੋਲਜੀ 'ਚ ਚੇਂਜ ਆਇਆ ਸਮਾਰਟ ਫੋਨ ਦੇ ਨਾਲ਼ ਇੱਦਾਂ ਲੱਗ ਰਿਹਾ ਕਿ ਜਿੱਦਾਂ ਅਸੀਂ ਦੁਨੀਆਂ ਨੂੰ ਆਪਣੀ ਮੁੱਠੀ 'ਚ ਕਰ ਲਿਆ ਹੁੰਦਾ ਕਿਉਂਕਿ ਇਹ ਛੋਟੇ ਜਿਹੇ ਫੋਨ 'ਚ ਬਹੁਤ ਕੁਝ ਅਵੇਲੇਬਲ ਹੈ ਅੱਜ ਕੱਲ੍ਹ ਅਸੀਂ ਵੀਡੀਓਸ ਦੇਖ ਲੈਂਦੇ ਹਾਂ ਕਿਤੇ ਅਸੀਂ ਜਿੱਥੇ ਕਿਤੇ ਗਏ ਵੀ ਨਹੀਂ ਹੋਣਗੇ ਉਹਦੀਆਂ ਵੀ ਫੋਟੋਸ ਦੇਖ ਲੈਂਦੇ ਉੱਥੇ ਦੀਆਂ ਵੀ ਵੀਡੀਓਸ ਦੇਖ ਲੈਂਦੇ ਕਿਉਂਕਿ ਲੋਕ ਪੋਸਟ ਹੀ ਇੰਨੀਆਂ ਕੁ ਜ਼ਿਆਦਾ ਕਰ ਦਿੰਦੇ ਨੇ ਸਨੈਪਚੈਟ 'ਤੇ ਆ ਸਨੈਪਚੈਟ 'ਤੇ ਇੱਕ ਸਨੈਪ ਮੈਪ ਹੈ ਉਹਦੇ 'ਤੇ ਤੁਸੀਂ ਪਾਉਂਗੇ ਤਾਂ ਤੁਸੀਂ ਜਿਵੇਂ ਸਨੈਪ ਮੈਪ 'ਤੇ ਸਨੈਪ ਪਾ ਦਿੱਤੀ ਉੱਤੇ ਲਿਖ ਦਿੱਤਾ ਕਿ ਅਸੀਂ ਅੱਜ ਇੱਥੇ ਨਵਾਂਸ਼ਹਿਰ ਐਸ ਉਹਦੇ 'ਤੇ ਰੈਸਟੋਰੈਂਟ 'ਤੇ ਆਏ ਹਾਂ ਤਾਂ ਜਦੋਂ ਤੁਸੀਂ ਉੱਥੇ ਟਚ ਕਰੋਗੇ ਬਹੁਤ ਲੋਕਾਂ ਦੀਆਂ ਫੋਟੋਸ ਉੱਥੇ ਮਿਲ ਜੂੰਗੀਆ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਚੀਜ਼ ਤਾਂ ਬਹੁਤ ਵਧੀਆ ਅਸੀਂ ਵੀ ਇੱਥੇ ਜਾਵਾਂਗੇ ਇੱਦਾਂ ਮਤਲਬ ਜਿਹੜੀ ਟੈਕਨੋਲਜੀ ਹੈ ਸਮਾਰਟ ਫੋਨ ਵਿੱਚ ਬਹੁਤ ਜ਼ਿਆਦਾ ਚੇਂਜ ਹੋ ਗਈ ਹੈ ਪਰ ਇਹਦਾ ਕਿਤੇ ਨਾ ਕਿਤੇ ਬੁਰਾ ਪ੍ਰਭਾਵ ਵੀ ਹੈ ਇਹ ਰਿਸ਼ਤਿਆਂ ਨੂੰ ਖਾ ਖਾ ਰਿਹਾ ਹੈ ਅਤੇ ਦੂਸਰੇ ਪਾਸੇ ਸਾਡੀ ਜਿਹੜੀ ਪੜ੍ਹਾਈ ਹੈ ਉਹਦੇ 'ਤੇ ਤਾਂ ਬੀ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਸਾਡੀ ਸਿਹਤ 'ਤੇ ਵੀ ਸਾਡੀਆਂ ਅੱਖਾਂ 'ਤੇ ਵੀ ਕਿਉਂਕਿ ਅਸੀਂ ਸਾਰਾ ਦਿਨ ਤਾਂ ਇਹਦੇ ਵਿੱਚ ਹੀ ਮ ਬੜੇ ਰਹਿੰਦੇ ਹਾਂ ਸਾਰਾ ਕੁਛ ਤਾਂ ਇਹਦੇ ਵਿੱਚ ਦੇਖੀ ਜਾਂਦੇ ਹਾਂ ਤਾਂ ਫਿਰ ਇਸ ਕਰਕੇ ਸਾਡੇ 'ਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ